ਹੈਲੋ ਵਧੀਆ ਵਧੀਆ ਉਸਤਾਦ ਤੂੰ ਸੁਣਾ ਕਿਵੇਂ ਆ ਵਧੀਆ ਵਧੀਆ ਹੋਰ ਮੇਜਰਾ ਵਧੀਆ ਬਸ ਚੱਲੀ ਜਾਂਦਾ ਤੂੰ ਦੱਸ ਫ਼ਸਲ ਕਿਵੇਂ ਹੋ ਗਈ ਐਤਕੀਂ ਉਹੀ ਹੈ ਭਰਾਵਾ ਉੱਥੇ ਗਏ ਤਾਂ ਅੱਜ ਭਰਾਵਾ ਮੈਂ ਸੁਣਨ 'ਚ ਆਇਆ ਵੀ ਉਹ ਵੀ ਹੈ ਤੇਰੇ ਤਾਂ ਘਰੇ ਵਿਆਹ ਵੀ ਰੱਖਿਆ ਕੁੜੀ ਦਾ

ਫ਼ਸਲ ਹੋਣੀ ਹੀ ਹੈਗੀ ਸਾਡੇ ਤਾਂ ਆਪ ਭਰਾਵਾ ਫ਼ਸਲ ਹੋਈ ਐਤਕੀਂ ਫ਼ਸਲ ਕਾਹਦੀ ਹੋਈ ਸਿਆਪਾ ਹੀ ਪੈ ਗਿਆ ਜਾਨ ਨੂੰ ਜਾ ਕੇ ਉਹ ਕੀਤਾ ਮੰਡੀ 'ਚ ਰੇਟ ਮੰਗ ਮੰਗਣ ਗਿਆ ਭਰਾਵਾ ਰੇਟ ਹੀ ਨਹੀਂ ਦਿੱਤਾ ਮੰਡੀ 'ਚ ਭਰਾਵਾ ਮੈਂ ਰੇਟ ਪੁੱਛਿਆ ਉਨ੍ਹਾਂ ਨੂੰ ਕਹਿੰਦੇ ਕਹਿੰਦੇ ਉਹੀ ਹੈ ਕਬ ਕੰਬਾਇਨਾਂ ਅੱਡ ਚੱਲਦੀਆਂ ਨੇ ਬਿਜਲੀ ਉਹ ਅੱਡ ਉਹ ਕਿਹੜਾ ਆਪਣੀਆਂ ਹੈਗੀਆਂ ਨੇ ਇੰਨੇ ਤਕੜੇ ਆਪਾ ਹੈ ਨਹੀਂ ਗੇ ਕਰਜ਼ਾ ਫਿਰ ਉਹ ਡਰ ਲੱਗਦਾ ਫਿਰ ਵੀ ਪੂਰਾ ਹੋਣਾ ਪਤਾ ਨਹੀਂ ਫਿਰ ਉਹੀ ਫਾਹੇ ਫਿਰ ਇਹ ਕਹਿੰਦੇ ਕਿਸਾਨ ਤੰਗ ਹੁੰਦਾ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਸਾਨ ਤੰਗ ਹੁੰਦਾ ਇਹ ਮੰਨਦੇ ਨਹੀਂ ਹੈਗੇ ਹੋਰ ਭਰਾਵਾ ਐਤਕੀਂ ਤਾਂ ਇੰਨਾ ਡਰ ਲੱਗਿਆ ਪਿਆ ਵੀ ਬਰਸਾਤਾਂ ਦਾ ਵੀ ਸਾਰੀ ਫ਼ਸਲ ਖਰਾਬ ਹੋ ਜਾਣੀ ਪਹਿਲਾਂ ਹੀ ਹੋਈ ਨਹੀਂ ਹੈਗੀ ਤਾਂ ਐਤਕੀਂ ਜਮਾਂ ਹੀ ਡੁੱਬ ਜਾਵਾਂਗੇ ਜੇ ਨਾ ਹੋਏ ਤਾਂ ਪੱਲਿਓਂ ਪੈਸੇ ਲੱਗਾ ਕੇ ਕੰਮ ਕਰਨਾ ਐਤਕੀਂ ਹੋਰ ਜਮਾਂ ਹੀ ਥੱਲੇ ਬੈਠ ਜਾਂਦੀ ਆ ਭਰਾਵਾ ਉੱਤੋਂ ਜਿਹੜੀ ਕੰਬਾਇਨ ਚੱਲਦੀ ਆ ਕੰਬਾਇਨ ਚੱਲਣ ਕਰਕੇ ਫਿਰ ਜ਼ੋਰ ਵੀ ਵੱਧ ਲੱਗਦਾ ਮਸ਼ੀਨ ਦਾ ਥੱਲੋਂ ਫ਼ਸਲ ਚੁੱਕਣੀ ਪੈਂਦੀ ਹੈ ਜਿਹੜੀ ਫ਼ਸਲ ਜਮਾਂ ਹੀ ਡੁੱਬ ਜਾਂਦੀ ਹੈ ਫਿਰ ਉਹਦਾ ਕੀ ਕਰਨਾ ਪੈਂਦਾ ਫਿਰ ਉਹ ਹੱਥ ਨਾਲ ਵੱਢੋ ਫਿਰ ਉਹ ਫਿਰ ਉਹ 'ਚੋਂ ਪਹਿਲਾਂ ਉਹਨੂੰ ਝਾੜੋ ਫਿਰ ਉਹ 'ਚੋਂ ਬੀਜ ਅੱਡ ਕੱਢੋ ਉਹਦੇ ਹੋਰ ਯੇ ਲਿਆ ਵੋ ਲਿਆ ਉਹ ਲਾਇਟ ਦਾ ਬਹੁਤ ਪੰਗਾ ਪੈਂਦਾ ਉਦੋਂ ਤਾਂ ਕਿਸਾਨ ਤੇ ਜਦੋਂ ਬੋਲਦੇ ਆਪਣੇ ਹੱਕ ਮੰਗਦੇ ਐ ਫਿਰ ਦਿੱਕਤ ਆਉਂਦੀ ਸਾਰਿਆਂ ਨੂੰ ਵੀ ਆਪਣੇ ਹੱਕ ਮੰਗਦੇ ਆ ਹੋਰ ਕਿੱਧਰ ਨੂੰ ਜਾਵੇ ਯਾਰ ਕਿਸਾਨ ਚੰਗਾ ਭਲਾ ਬੰਦਾ ਸ ਉਹ ਵੀ ਛੱਡੇ ਕਿਰਾਏ ਬਿਨਾਂ ਰਹਿ ਨਹੀਂ ਸਕਦੇ ਹੈਗੇ ਅੱਜ ਤਾਂ ਬਹੁਤ ਭਰਾਵਾ ਬੁਰਾ ਹਾਲ ਕੀ ਕਿਹਾ ਜਾਵੇ ਅੱਜ ਵੀ ਨਾ ਬੁਰਾ ਹਾਲ ਆ ਹੋਰ ਚਲੋ ਠੀਕ ਆ ਵੀਰੇ ਓਕੇ